ਮੈਂ ਆਪਣੇ ਸੰਗ੍ਰਹਿ ਦਾ ਧਿਆਨ ਰੱਖਣ ਲਈ ਹਜੇ ਕਿਸੇ ਵੀ ਡਾਟਾਬੇਸ ਜਾਂ ਕਿਸੇ ਹੋਰ ਸਿਸਟਮ ਦਾ ਵਰਤੋਂ ਨਹੀਂ ਕੀਤਾ ਕਿਵੇਂ ਮੈਂ ਆਪਣੇ ਸਟੈਂਪ ਦੇ ਸੰਗ੍ਰਹਿ ਲਈ ਇਹ ਆਪਣਾ ਲਿਖਤੀ ਵੇਰਵਾ ਰੱਖਿਆ ਹੋਇਆ ਮਤਲਬ ਮੈਂ ਕਿਸੇ ਇਹ ਕਾਪੀ 'ਚ ਨੋਟ ਕਰ ਲੈਂਦੀ ਹਾਂ ਵੀ ਇਹ ਸਟੈਂਪ ਕਿਹੜੀ ਸਟੈਂਪ ਕਿੱਧਰੋਂ ਕਿਹੜੇ ਸ਼ਹਿਰ ਦੀ ਹੈ ਅਤੇ ਸਟੈਂਪ ਕਿਸ ਕਿੱਧਰੋਂ ਆਈ ਹੈ ਕਿਹੜੀ ਤਾਰੀਖ ਨੂੰ ਆਈ ਹੈ ਡੇਟ ਵਗੈਰਾ ਸਭ ਕੁਝ ਲਿਖਤੀ ਵੇਰਵੇ 'ਚ ਰੱਖਦੀ ਹਾਂ ਹਜੇ ਤੱਕ ਮੈਂ ਕਿਸੇ ਸਿਸਟਮ ਜਾਂ ਉਹਦਾ ਵਰਤੋਂ ਨਹੀਂ ਕੀਤਾ ਡੇਟਾਬੇਸ ਦਾ ਵਰਤੋਂ ਨਹੀਂ ਕੀਤਾ ਅਤੇ ਮੈਂ ਸਿੱਕਿਆਂ ਸਿੱਕਿਆਂ ਦਾ ਵੀ ਰੱਖਿਆ ਵੀ ਕਿਸ ਮਟੀਰੀਅਲ ਦਾ ਕਿਹੜੇ ਕਿਹੜੇ ਮਟੀਰੀਅਲ ਸਿੱਕਿਆਂ ਵਿੱਚ ਯੂਜ ਹੋਏ ਹਨ ਮਤਲਬ ਇਸਤੇਮਾਲ ਕੀਤੇ ਗਏ ਹਨ ਉਹਨਾਂ ਦਾ ਲਿਖਤੀ ਵੇਰਵਾ ਰੱਖਦੀ ਹਾਂ ਆਪਣੀ ਕਾਪੀ 'ਚ ਨੋਟ ਕਰ ਲੈਂਦੀ ਹਾਂ ਵੀ ਇਹ ਜਿਹੜਾ ਤਾਂਬੇ ਦਾ ਸਿੱਕਾ ਇਹਨੂੰ ਬਣਾਉਣ ਲਈ ਮਤਲਬ ਕਦੋਂ ਇਹ ਸ਼ੁਰੂ ਹੋਇਆ ਸੀ ਤਾਂਬੇ ਦਾ ਸਿੱਕਾ ਅਤੇ ਕਿਹੜਾ ਕਿਹੜਾ ਮਟੀਰੀਅਲ ਇਸ ਵਿੱਚ ਪਾਇਆ ਜਾਂਦਾ ਹੈ ਅਤੇ ਤਾਂਬੇ ਦਾ ਸਿੱਕਾ ਕਿੱਦਾਂ ਦਾ ਹੁੰਦਾ ਹੈ ਅਤੇ ਕਿਸ ਮਤਲਬ ਕਿ ਈਅਰ ਵਿੱਚ ਇਹ ਸ਼ੁਰੂ ਹੋਇਆ ਸੀ ਤੀਸਰਾ ਮਤਲਬ ਪੱਥਰਾਂ ਦੀ ਕਲੈਕਸ਼ਨ ਲਈ ਮੈਂ ਇਹਦੇ ਲਈ ਮੈਂ ਇੰਟਰਨੈਟ ਦਾ ਇਸਤੇਮਾਲ ਕਰਦੀ ਹਾਂ ਮੈਂ ਇੰਟਰਨੈਟ 'ਤੇ ਪਤਾ ਕਰਦੀ ਹਾਂ ਕਿਹੜਾ ਪੱਥਰ ਕਿੰਨਾ ਕੀਮਤੀ ਹੈ ਅਤੇ ਕਿਹੜਾ ਪੱਥਰ ਕਿੱਥੋਂ ਪਾਇਆ ਜਾਂਦਾ ਚੱਟਾਨ ਕਿੱਥੋਂ ਪਾਈ ਜਾਂਦੀ ਹੈ ਅਤੇ ਚੱਟਾਨਾਂ ਦੀ ਕੀਮਤ ਕੀ ਹੈ ਕਿਹੜੇ ਚੱਟਾਨ ਜ਼ਿਆਦਾ ਕੀਮਤੀ ਹੁੰਦੀ ਕਿਹੜੇ ਚੱਟਾਨ ਸਧਾਰਨ ਹੈ ਤਾਂ ਇਹਨਾਂ ਲਈ ਮੈਂ ਸਿਸਟਮ 'ਤੇ ਇੰਟਰਨੈਟ ਵਗੈਰਾ ਦੀ ਵਰਤੋਂ ਕਰ ਲੈਂਦੀ ਹਾਂ ਤਾਂ ਕਿ ਮੈਨੂੰ ਜਾਣਕਾਰੀ ਮਿਲਦੀ ਰਹੇ ਵੀ ਕਿਹੜਾ ਚੱਟਾਨ ਕਿੱਥੋਂ ਪਾਈ ਜਾਂਦੀ ਆ ਕਿਹੜੇ ਚੱਟਾਨ ਦੀ ਕੀਮਤ ਕਿੰਨੀ ਹੈ ਅਤੇ ਇਹ ਚੱਟਾਨ ਮਤਲਬ ਕਿਸ ਜਗ੍ਹਾ ਤੋਂ ਪਾ ਪਾਈ ਜਾਂਦੀ ਹੈ ਅਤੇ ਚੱਟਾਨਾਂ ਨੂੰ ਉ ਕਲੈਕਟ ਕਰਨ ਲਈ ਇਸ ਇਹਨਾਂ ਦਾ ਸੰਗ੍ਰਹਿ ਬਣਾਉਣ ਲਈ ਮੈਨੂੰ ਕਿਸ ਚੀਜ਼ ਦੀ ਵਰਤੋਂ ਕਰਨੀ ਪਵੇਗੀ ਪਰ ਸਟੈਂਪ ਜਾਂ ਫਿਰ ਮੈਂ ਸਿੱਕਿਆਂ ਲਈ ਕਿਸੇ ਵੀ ਸਿਸਟਮ ਦੀ ਵਰਤੋਂ ਨਹੀਂ ਕਰਦੀ ਕਿਸੇ ਵੀ ਡੇਟਾਬੇਸ ਦੀ ਵਰਤੋਂ ਨਹੀਂ ਕੀਤੀ ਇਸ ਲਈ ਮੈਂ ਆਪਣਾ ਲਿਖਤੀ ਵੇਰਵਾ ਆਪਣਾ ਅਲੱਗ ਬਣਾਇਆ ਹੈ ਵੀ ਤਾਂ ਕਿ ਮੈਨੂੰ ਪਤਾ ਚੱਲਦਾ ਰਹੇ ਮੈਂ ਕਿਹੜੀ ਚੀਜ਼ ਨੂੰ ਕਦੋਂ ਸੰਗ੍ਰਿਹ ਬਣਾਇਆ ਕਦੋਂ ਕਿਸ ਚੀਜ਼ ਨੂੰ ਕਲੈਕਟ ਕੀਤਾ ਸੀਗਾ